ਪੰਜਾਬ ਕਲਾਵਾਂ ਦੀ ਧਰਤੀ ਹੈ ਇੱਥੇ ਤਰ੍ਹਾਂ ਤਰ੍ਹਾਂ ਦੇ ਲੋਕਨਾਚ ਅਤੇ ਨਾਚ ਹੁੰਦੇ ਆ ਜਿਵੇਂ ਭੰਗੜਾ ਅਤੇ ਗਿੱਧਾ ਇਹ ਸਾਰੇ ਨਾਚ ਇੱਕ ਵੱਡੇ ਪੱਧਰ 'ਤੇ ਲੋਕਾਂ ਨੂੰ ਦਰਸ਼ਕਾਂ ਨੂੰ ਆਪਣੀ ਔਰ ਆਕਰਸ਼ਿਤ ਕਰਦੇ ਹਨ ਪੰਜਾਬ ਵਿੱਚ ਪਿਛਲੇ ਪੰਜ ਸੌ ਸਾਲਾਂ ਵਿੱਚ ਬਹੁਤ ਸਾਰੀ ਕਲਾਵਾਂ ਜਾਗਰਿਤ ਹੋਈਆਂ ਹਨ ਜਿਨ੍ਹਾਂ ਵਿੱਚੋਂ ਕੁਝ ਦੇ ਨਾਮ ਹਨ ਗੱਤਕਾ ਕਿੱਕਲੀ ਸੰਮੀ ਗੱਤਕਾ ਮਾਰਸ਼ਲ ਆਰਟਸ ਦੀ ਇੱਕ ਫੋਰਮ ਹੈਗੀ ਹੈ ਜਿਨ੍ਹਾਂ ਨੂੰ ਸਿੱਖ ਧਰਮ ਦੇ ਲੋਕ ਆਪਣੇ ਵੱਡੇ ਵੱਡੇ ਕਾਰਿਆਕ੍ਰਮਾਂ 'ਚ ਦਿਖਾਉਂਦੇ ਆ ਕਿੱਕਲੀ ਉਸ ਕਲਾ ਦਾ ਨਾਮ ਹੈ ਜਿਸ ਵਿੱਚ ਦੋ ਲੋਕ ਆਪਣੇ ਹੱਥ ਫੜ ਕੇ ਘੁੰਮਦੇ ਹਨ ਇੱਕ ਗੋਲ ਦਿਸ਼ਾ ਵਿੱਚ ਅਲੱਗ ਅਲੱਗ ਪ੍ਰਕਾਰ ਦੇ ਸੰਗੀਤ ਅਤੇ ਤਿਉਹਾਰਾਂ ਵਿੱਚ ਨਾਚਾਂ ਨੂੰ ਪ੍ਰਦਰਸ਼ਿਤ ਕੀਤਾ ਜਾਂਦਾ ਹੈ ਦਰਸ਼ਕ ਇਹਨਾਂ ਨੂੰ ਦੇਖ ਕੇ ਬਹੁਤ ਖੁਸ਼ ਹੁੰਦੇ ਹਨ ਗੀਤਾਂ ਦੀ ਸੂਚੀ ਪੰਜਾਬ ਵਿੱਚ ਬਹੁਤ ਵੱਡੀ ਹੈ ਅਲੱਗ ਅਲੱਗ ਕਾਰਿਆਕ੍ਰਮਾਂ ਵਿੱਚ ਅਲੱਗ ਅਲੱਗ ਪ੍ਰਕਾਰ ਦੇ ਗੀਤ ਗਾਏ ਜਾਂਦੇ ਹਨ ਜਿਵੇਂ ਵਿਆਹਵਾਂ ਲਈ ਅਲੱਗ ਅਲੱਗ ਤਰ੍ਹਾਂ ਦੇ ਗੀਤ ਹੁੰਦੇ ਹਨ ਕਿਸੇ ਦੇ ਜਨਮ ਦਿਨ ਦੇ ਔਰ ਅਲੱਗ ਤਰ੍ਹਾਂ ਦੇ ਗੀਤ ਹੁੰਦੇ ਆ ਗੱਤਕਾ ਸੰਮੀ ਕਿੱਕਲੀ ਅਲੱਗ ਅਲੱਗ ਤਰ੍ਹਾਂ ਦੇ ਆਰਟਸ ਦੇ ਨਾਮ ਹਨ ਜੋ ਇੱਕ ਅਗਲੇ ਲੈਵਲ ਦੇ ਦਰਸ਼ਕਾਂ ਨੂੰ ਆਕਰਸ਼ਿਤ ਕਰਦੇ ਹਨ ਭੰਗੜਾ ਪੂਰੇ ਪੰਜਾਬ ਵਿੱਚ ਕਰਿਆ ਕੀਤਾ ਜਾਂਦਾ ਹੈ ਅੱਜ ਭੰਗੜਾ ਪੂਰੇ ਦੇਸ਼ ਵਿੱਚ ਪੂਰੀ ਦੁਨੀਆ ਵਿੱਚ ਇਸ ਤਰ੍ਹਾਂ ਨਾਲ ਮਸ਼ਹੂਰ ਹੋਇਆ ਹੈ ਕਿ ਹਰ ਕੋਈ ਇਸ ਬਾਰੇ ਜਾਣਦਾ ਹੈ ਭੰਗੜਾ ਅਤੇ ਗਿੱਧਾ ਪੰਜਾਬ ਦੀ ਕਲਾਵਾਂ ਦੀ ਰੀੜ ਦੀ ਹੱਡੀ ਹਨ ਸੰਮੀ ਉਹ ਪਾਰੰਪਰਿਕ ਨਾਚ ਹੁੰਦਾ ਹੈ ਜੋ ਕੁੜੀਆਂ ਮਟਕੀ ਫੜ ਕੇ ਕਰਦੀਆਂ ਹਨ ਅੱਜ ਕੱਲ੍ਹ ਪੰਜਾਬ ਦੇ ਨਾਚ ਅਤੇ ਗੀਤ ਪੂਰੀ ਦੁਨੀਆ ਵਿੱਚ ਬਹੁਤ ਮਸ਼ਹੂਰ ਹੋ ਗਏ ਹਨ ਅੱਜ ਕੱਲ੍ਹ ਪੰਜਾਬ ਇਹਨਾਂ ਗੀਤਾਂ ਅਤੇ ਨਾਚਾਂ ਦੇ ਸਰ 'ਤੇ ਬਹੁਤ ਉੱਤੇ ਚਲਾ ਗਿਆ ਹੈ ਪੰਜਾਬ ਵਿੱਚ ਪ੍ਰਮੁੱਖ ਸੰਗੀਤ ਅਤੇ ਨਰਿਤ ਤਿਉਹਾਰ ਜਾਂ ਸਮਾਗਮ ਇਹ ਹੀ ਹਨ ਸਾਉਣ ਦੇ ਮਹੀਨੇ ਵਿੱਚ ਵੀ ਇਸ ਤਰ੍ਹਾਂ ਦਾ ਕੁਛ ਕਾਰਿਆਕ੍ਰਮ ਹੁੰਦਾ ਹੈ ਅਤੇ ਲੋਕ ਇਹਨਾਂ ਸਾਰੀਆਂ ਚੀਜ਼ਾਂ ਨੂੰ ਵੇਖ ਕੇ ਬਹੁਤ ਖੁਸ਼ ਹੁੰਦੇ ਹਨ